ਮੈਂ ਨੌਕਰੀ ਲਈ ਔਨਲਾਈਨ ਫਾਰਮ ਭਰਿਆ ਹੋਇਆ ਸੀ ਇਹ ਇੱਕ ਪ੍ਰਾਈਵੇਟ ਕੰਪਨੀ ਵਿੱਚ ਸਿਕਿਉਰਟੀ ਗਾਰਡ ਦੀਆਂ ਅਸਾਮੀਆਂ ਨਿਕਲੀਆਂ ਹੋਈਆਂ ਸਨ ਮੈਂ ਪਿੰਡ ਦੇ ਆਮ ਸਕੂਲ ਵਿੱਚ ਪੜ੍ਹਿਆ ਸਾਂ ਅੰਗਰੇਜ਼ੀ ਭਾਸ਼ਾ ਬੋਲਣ ਅਤੇ ਲਿਖਣ ਵਿੱਚ ਮੈਨੂੰ ਬੜੀ ਪਰੇਸ਼ਾਨੀ ਆਉਂਦੀ ਸੀ ਜਦੋਂ ਮੈਂ ਪੰਜ ਅਗਸਤ ਦੋ ਹਜ਼ਾਰ ਚੌਵੀ ਨੂੰ ਪੇਪਰ ਦੇਣ ਲਈ ਗਿਆ ਤਾਂ ਪੇਪਰ ਵਿੱਚ ਇੱਕ ਅਨੁਵਾਦ ਵਾਲਾ ਭਾਗ ਸੀ ਉਸ ਵਿੱਚ ਅੰਗਰੇਜ਼ੀ ਦੀਆਂ ਕੁਝ ਸਤਰਾਂ ਦਿੱਤੀਆਂ ਹੋਈਆਂ ਸਨ ਜਿਨ੍ਹਾਂ ਨੂੰ ਪੰਜਾਬੀ ਵਿੱਚ ਅਨੁਵਾਦ ਕਰਨਾ ਸੀ ਮੈਨੂੰ ਉਸ ਪੇਪਰ ਵਿੱਚ ਬੜੀ ਪਰੇਸ਼ਾਨੀ ਆਈ ਕਿਉਂਕਿ ਇਹ ਸਤਰਾਂ ਕਵਿਤਾ ਦੀਆਂ ਸਨ ਅਤੇ ਕਵਿਤਾ ਵਿੱਚ ਛੰਦਾਂ ਅਤੇ ਅਲੰਕਾਰਾਂ ਦਾ ਢੁਕਵਾਂ ਅਨੁਵਾਦ ਕਰਨਾ ਬੜਾ ਮੁਸ਼ਕਿਲ ਹੁੰਦਾ ਹੈ ਕਿਉਂਕਿ ਛੰਦਾਂ ਅਤੇ ਅਲੰਕਾਰਾਂ ਲਈ ਕੋਈ ਢੁਕਵੇਂ ਸ਼ਬਦ ਛੇਤੀ ਨਹੀਂ ਲੱਭਦੇ ਅਤੇ ਦੂਸਰਾ ਜੋ ਅੰਗਰੇਜ਼ੀ ਪੇਪਰ ਵਿੱਚ ਪਾਈ ਗਈ ਸੀ ਉਹ ਅੰਗਰੇਜ਼ੀ ਜੋ ਅੰਗਰੇਜ਼ੀ ਮੈਨੂੰ ਆਉਂਦੀ ਸੀ ਉਸ ਨਾਲ ਬਿਲਕੁਲ ਵੀ ਨੇੜਤਾ ਨਹੀਂ ਸੀ ਦਿਖਾ ਰਹੀ ਇਸ ਲਈ ਮੈਨੂੰ ਉਸ ਪੇਪਰ ਵਿੱਚ ਅਨੁਵਾਦ ਕਰਨ ਲਈ ਬਹੁਤ ਪਰੇਸ਼ਾਨੀ ਮਹਿਸੂਸ ਹੋਈ ਕਵਿਤਾ ਨਾਲ ਮੇਰਾ ਦੂਰ ਦੂਰ ਤੱਕ ਵਾਸਤਾ ਨਹੀਂ ਸੀ ਇਸ ਲਈ ਮੈਂ ਕਵਿਤਾ ਦਾ ਜਿਹੜਾ ਅੰਗਰੇਜ਼ੀ ਦੀਆਂ ਸਤਰਾਂ ਸੀ ਉਹਨਾਂ ਨੂੰ ਨਹੀਂ ਅਨੁਵਾਦ ਕਰ ਸਕਿਆ